ਜੀ ਹਾਂ ਇੱਕ ਨਵਜੰਮੇ ਬੱਚੇ ਲਈ ਉਸ ਦੇ ਪਹਿਲੇ ਸਾਲ ਦੇ ਦੌਰਾਨ ਪਰਿਵਾਰ ਦੇ ਵਿੱਚ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ ਵੈਸੇ ਤਾਂ ਪਰਿਵਾਰ ਦੇ ਵਿੱਚ ਬੱਚੇ ਦਾ ਜਨਮ ਜਿਹੜਾ ਖੁਸ਼ੀਆਂ ਅਤੇ ਖੇੜੇ ਲੈ ਕੇ ਆਉਂਦਾ ਹੈ ਬੱਚੇ ਦੇ ਜਨਮ ਦੇ ਨਾਲ ਹੀ ਘਰ ਦੇ ਵਿੱਚ ਕਈ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਈ ਛੋਟੀਆਂ ਛੋਟੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਪਹਿਲੇ ਸਾਲ ਦੇ ਦੌਰਾਨ ਹੀ ਬੱਚੇ ਦੀ ਹਰ ਇੱਕ ਜਿਹੜੀ ਹੈ ਕਿਰਿਆ ਦੇ ਨਾਲ ਸੰਬੰਧਿਤ ਜਿਹੜੀਆਂ ਰਸਮਾਂ ਹੁੰਦੀਆਂ ਨੇ ਜਿਵੇਂ ਪਹਿਲੀ ਵਾਰ ਨਹਾਉਣਾ ਗੁੜਤੀ ਦੇਣੀ ਸਵਾ ਮਹੀਨਾ ਮਨਾਉਣਾ ਨਾਮਕਰਨ ਕਰਨਾ ਮੁੰਡਨ ਕਰਨਾ ਪਹਿਲੀ ਵਾਰ ਘਰੋਂ ਬਾਹਰ ਲੈ ਕੇ ਜਾਣ ਦੀ ਰਸਮ ਕੋਈ ਠੋਸ ਭੋਜਨ ਖੁਆਉਣ ਦੀ ਰਸਮ ਜਿਸ ਨੂੰ ਅਨਭਰਾਸ਼ਨ ਕਿਰਿਆ ਕਹਿੰਦੇ ਹਨ ਕੁੜੀਆਂ ਦੇ ਵਿੱਚ ਕੰਨ ਛਿਦਵਾਉਣ ਦੀ ਰਸਮ ਇਸ ਤੋਂ ਇਲਾਵਾ ਬੱਚਿਆਂ ਦੇ ਪਹਿਲੇ ਤਿਉਹਾਰ ਜਿਵੇਂ ਕਿ ਮੁੱਖ ਤੌਰ 'ਤੇ ਲੋਹੜੀ ਜਿਹੜੀ ਹੈ ਮਨਾਈ ਜਾਂਦੀ ਹੈ ਇਸ ਤਰ੍ਹਾਂ ਜਿਹੜੀਆਂ ਨੇ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਰਸਮਾਂ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਸਾਲ ਦੇ ਵਿੱਚ ਮਨਾਈਆਂ ਜਾਂਦੀਆਂ ਹਨ